ਚਿੱਤਰਕਾਰੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਜਦੋਂ ਤੁਹਾਡੀ ਸੋਚ ਹੈ ਸੋਚ ਦੇ ਵਿੱਚ ਤੁਹਾਨੂੰ ਜੋ ਚੀਜ਼ ਤੁਸੀਂ ਬਿਠਾ ਕੇ ਬੈਠਦੇ ਹੋ ਕਿ ਵੀ ਮੈਂ ਇਹ ਬਣਾਉਣਾ ਚਾਹੁੰਦਾ ਹਾਂ ਤਾਂ ਉਸ ਨੂੰ ਆਪਣੀ ਕਲਮ ਦੇ ਨਾਲ ਆਪਣੀ ਰੰਗਾਂ ਦੀ ਮਦਦ ਦੇ ਨਾਲ ਖਾਲੀ ਪੰਨੇ ਦੇ ਉੱਤੇ ਉਤਾਰਨਾ ਉਫ਼ ਭਾਵਾਂ ਨੂੰ ਭਾਵਨਾਵਾਂ ਨੂੰ ਦਰਸਾਉਣਾ ਉਸ ਦੇ ਵਿੱਚ ਤੁਹਾਡੀ ਬਹੁਤ ਮਿਹਨਤ ਲੱਗਦੀ ਹੈ ਤਾਂ ਜੋ ਤੁਸੀਂ ਉਸ ਨੂੰ ਕਰਦੇ ਹੋ ਤਾਂ ਤੁਹਾਡਾ ਜਿਹੜਾ ਵਿੱਚ ਵਾਲਾ ਤਾਲਮੇਲ ਹੈ ਉਹ ਟੁੱਟ ਜਾਂਦਾ ਬਹੁਤ ਵਾਰ ਹੁੰਦਾ ਹੈ ਕਿ ਤੁਹਾਡੀ ਜੇਈ ਤਾਲਮੇਲ ਟੁੱਟਣ ਦਾ ਕਾਰਨ ਬਣਦਾ ਹੈ ਕਿ ਤ ਤੁਸੀਂ ਉਸ ਦੇ ਉੱਤੇ ਧਿਆਨ ਨਾਲ ਆਪਣਾ ਇਕਾਗਰਤਾ ਨਾਲ ਕੰਮ ਨਹੀਂ ਕਰਦੇ ਹੁੰਦੇ ਉ ਇਕਾਗਰਤਾ ਦੀ ਕਮੀ ਦੇ ਕਾਰਨ ਜੋ ਤਾਲਮੇਲ ਟੁੱਟਦਾ ਹੈ ਤਾਂ ਜਿਹੜੀਆਂ ਉਹ ਭਾਵਨਾਵਾਂ ਦਰਸਾਉਣੀਆਂ ਹੁੰਦੀਆਂ ਹਨ ਉਹ ਉਸ ਦੇ ਉੱਤੇ ਤੁਸੀਂ ਨਹੀਂ ਦਰਸਾ ਪਾਉਂਦੇ ਤੁਹਾਡਾ ਜਿਹੜਾ ਚਿੱਤਰ ਹੈ ਤੁਹਾਡਾ ਜਿਹੜਾ ਅੱਗੇ ਤੁਸੀਂ ਚਿੱਤਰ ਬਣਾ ਰਹੇ ਹੋ ਉਹ ਉਸ ਭਾਵਨਾਵਾਂ ਨੂੰ ਨਹੀਂ ਦਰਸਾ ਪਾਉਂਦਾ ਉਸ ਦੇ ਵਿੱਚ ਕੁਛ ਕਮੀ ਹੈ ਜਿਹੜੀ ਉਹ ਮਹਿਸੂਸ ਹੁੰਦੀ ਹੈ ਤਾਂ ਹਮੇਸ਼ਾ ਜਦੋਂ ਵੀ ਤੁਸੀਂ ਇਸ ਗਲਤੀਆਂ ਨੂੰ ਸੁਧਾਰਨ ਦਾ ਕੰਮ ਇਹ ਹੀ ਹੈ ਕਿ ਜਦੋਂ ਵੀ ਤੁਸੀਂ ਆਪਣਾ ਚਿੱਤਰ ਬਣਾਉਣ ਲਈ ਬੈਠੋ ਪਹਿਲਾਂ ਤਾਂ ਆਪਣੀ ਸੋਚ ਨੂੰ ਇਕਦਮ ਇਕਾਗਰਚਿੱਤ ਕਰ ਲਓ ਅਤੇ ਇਕਾਗਰ ਚਿੱਤਤਾ ਨਾਲ ਤੁਸੀਂ ਆਪਣੇ ਚਿੱਤਰ ਨੂੰ ਪੰਨੇ ਦੇ ਉੱਤੇ ਉਤਾਰੋ ਉਸ 'ਤੇ ਸਹੀ ਰੰਗ ਭਰੋ ਜੋ ਤੁਹਾਡੀ ਸੋਚ ਨੂੰ ਸਹੀ ਲੱਗਦੇ ਹਨ ਨਾ ਕਿ ਜੋ ਕਿ ਦੁਨੀਆ ਨੂੰ ਸਹੀ ਲੱਗਦੇ ਹਨ ਕਿਉਂਕਿ ਦੁਨੀਆ ਕਲਾਕਾਰ ਨੂੰ ਸਮਝ ਅਗਰ ਦੁਨੀਆ ਦੇ ਹਿਸਾਬ ਨਾਲ ਕਲਾਕਾਰ ਕੰਮ ਕਰੇਗਾ ਤਾਂ ਜੋ ਉਸ ਦੀ ਸੋਚ ਹੈ ਉਹ ਨਵੀਂ ਨਹੀਂ ਬਣ ਸਕੇਗੀ ਤਾਂ ਕਿ ਤਾਂ ਇਸ ਲਈ ਉਸ ਗਲਤੀਆਂ ਨੂੰ ਸੁਧਾਰਨ ਦੇ ਲਈ ਆਪਣੀ ਇਕਾਗਰਚਿੱਤਤਾ ਬਹੁਤ ਜ਼ਰੂਰੀ ਹੈ ਅਤੇ ਉਹ ਤਾਲਮੇਲ ਹੈ ਜੋ ਹੱਥਾਂ ਦਾ ਤੁਹਾਡੇ ਦਿਮਾਗ ਨਾਲ ਅਤੇ ਫਿਰ ਉਨ੍ਹਾਂ ਅੱਖਾਂ ਦਾ ਜੋ ਕਿ ਉਸ ਨੂੰ ਦੇਖ ਰਹੀਆਂ ਹਨ ਕਿ ਵੀ ਸਹੀ ਹੈ ਨਹੀਂ ਹੈ ਤਾਂ ਉਹ ਬਹੁਤ ਜ਼ਰੂਰੀ ਹੈ ਤੁਹਾਡਾ ਹਰ ਇੱਕ ਅੰਗ ਉਸ ਦੇ ਵਿੱਚ ਖੁੱਭ ਜਾਣਾ ਚਾਹੀਦਾ ਹੈ ਤਾਂ ਕਿ ਤੁਸੀਂ ਹਰ ਆਪਣੇ ਅੰਗਾਂ ਦੇ ਵਿੱਚੋਂ ਪਹਿਚਾਣ ਕਰ ਸਕੋ ਕਿ ਵੀ ਕਿਸ ਰੰਗ ਨਾਲ ਤੁਸੀਂ ਉਸ ਭਾਵਨਾਵਾਂ ਨੂੰ ਦਰਸਾ ਸਕਦੇ ਹੋ